ਸਤਿ ਸ਼੍ਰੀ ਅਕਾਲ ਜੀ ਹਾਂਜੀ ਬੁਣਾਈ ਅਤੇ ਸਿਲਾਈ ਤਕਨੀਕਾਂ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਹਨ ਜੋ ਕਿ ਮੈਂ ਭਵਿੱਖ ਵਿੱਚ ਸਿੱਖਣਾ ਚਾਹਾਂਗੀ ਕਿਉਂਕਿ ਅੱਜ ਕੱਲ੍ਹ ਖੁਦ ਦੇ ਖੁਦ ਨੂੰ ਵੀ ਕੋਈ ਨਾ ਕੋਈ ਕੰਮ ਆਉਣਾ ਚਾਹੀਦਾ ਹੈ ਅੱਜ ਕੱਲ੍ਹ ਹੱਥੀਂ ਕੰਮ ਕਰਨ ਦੀ ਬਹੁਤ ਡਿਮਾਂਡ ਹੈ ਅੱਜ ਦੀ ਜਨਰੇਸ਼ਨ ਜੋ ਕਿ ਸੂ ਸੂਟਾਂ ਨੂੰ ਸਵਾਉਣ ਲਈ ਉਹਨਾਂ 'ਤੇ ਡਿਜ਼ਾਇਨ ਪਵਾਉਣ ਲਈ ਉਹਨਾਂ 'ਤੇ ਕਢਾਈ ਕਰਨ ਲਈ ਲੱਖਾਂ ਪੈਸੇ ਖਰਚ ਕਰਦੀਆਂ ਹਨ ਜੇਕਰ ਉਹੀ ਕੰਮ ਮੈਂ ਸਿੱਖਿਆ ਹੋਵੇਗਾ ਤਾਂ ਉਸ ਬਾਰੇ ਮੈਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੂਗੀ ਅਤੇ ਮੈਂ ਆਪਣੇ ਪੈਸਿਆਂ ਦੀ ਬੱਚਤ ਕਰ ਸਕਦੀ ਹਾਂ ਮੈਂ ਸਿਲਾਈ ਦਾ ਕੰਮ ਭਵਿੱਖ ਵਿੱਚ ਇਸ ਲਈ ਸਿੱਖਣਾ ਚਾਹੁੰਦੀ ਹਾਂ ਕਿ ਕੱਪੜੇ ਸੂਟਾਂ ਦਾ ਰਿਵਾਜ ਕਦੇ ਵੀ ਪੁਰਾਣਾ ਨਹੀਂ ਹੁੰਦਾ ਸੂਟਾਂ ਦਾ ਰਿਵਾਜ ਹਮੇਸ਼ਾ ਹੀ ਨਵਾਂ ਨਵੀਨ ਰਹਿੰਦਾ ਹੈ ਇਸ ਲਈ ਲੋਕ ਵੱਧ ਤੋਂ ਵੱਧ ਸੂਟ ਸਵਾਉਂਦੇ ਹਨ ਅਤੇ ਮੈਂ ਇਸ ਦੇ ਹੋਰ ਬਹੁਤ ਚੀਜ਼ਾਂ ਇਹਦੀ ਜਾਣਕਾਰੀ ਇਸਦੇ ਟ੍ਰੈਂਡਸ ਬਾਰੇ ਵੀ ਸੋ ਜਾਣਨਾ ਚਾਹੁੰਦੀ ਹਾਂ